ਸਹੀਦ ਭਗਤ ਸਿੰਘ ਦੇ ਆਜ਼ਾਦੀ ਦੇ ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ ਬਹੁਤ ਮਹੱਤਵਪੂਰਨ ਸੀ ਉਹ ਅਠਾਈ ਸਾਲ ਦੀ ਉਮਰ ਵਿੱਚ ਸਿੰਘਾਂ ਅਤੇ ਹੋਰ ਵਿਰੋਧੀਆਂ ਦੇ ਪ੍ਰੇਰਨਾ ਸਾਧਨ ਬਣੇ ਭਗਤ ਸਿੰਘ ਦਾ ਜਨਮ ਉੱਨੀ ਸੌ ਸੱਤ ਈਸਵੀ ਵਿੱਚ ਪੰਜਾਬ ਦੇ ਬੰਗੀ ਖਾਨਦਾਨ ਵਿੱਚ ਹੋਇਆ ਉਨ੍ਹਾਂ ਦੀ ਸੋਚ ਅਤੇ ਰਾਸ਼ਟਰਵਾਦ ਵਿੱਚ ਸਮਾਜਵਾਦ ਦੇ ਆਸਰੇ ਛੋਟੀ ਉਮਰ ਵਿੱਚ ਹੀ ਉਹਨਾਂ ਨੇ ਬ੍ਰਿਸਟ ਰਾਜ ਖਿਲਾਫ ਵਿਰੋਧੀ ਚੀਜ਼ਾਂ ਦਾ ਸਾਹਮਣਾ ਕੀਤਾ ਉਹ ਲਾਹੌਰ ਵਿਖੇ ਗਦਰ ਪਾਰਟੀ ਅਤੇ ਫਿਰ ਹਿੰਦੁਸਤਾਨ ਸ਼ੁਕੀਆਲਿਸਟ ਰਪਬਲਿਕ ਐਸੋਸੀਏਸਨ ਨਾਲ ਜੁੜ ਗਏ ਇਹਨਾਂ ਸੰਗਠਨਾਂ ਨੇ ਬ੍ਰਿਸਟ ਹਕੂਮਤ ਖਿਲਾਫ ਹਮਲਿਆਂ ਦੀ ਯੋਜਨਾ ਬਣਾਈ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਉੱਨੀ ਸੌ ਅਠਾਈ ਵਿੱਚ ਸੀਟੀ ਪੁਲਿਸ ਦੇ ਅਧਿਕਾਰੀ ਜੇ ਐਸ ਸਿੰਘ ਦੇ ਵਿਰੁੱਧ ਹਮਲਾ ਕੀਤਾ ਇਸ ਦੇ ਬਾਅਦ ਉਹਨਾਂ ਨੇ ਲਾਹੌਰ ਵਿਖੇ ਬੀ ਐਸ ਐਲ ਰਾਏ ਦੇ ਮ ਦੇ ਮਾਰਨ ਦੀ ਯੋਜਨਾ ਬਣਾਈ ਸੀ ਪਰ ਗਲਤੀ ਨਾਲ ਉਹਨਾਂ ਤੋਂ ਕੁਝ ਹੋਰ ਲੋਕਾਂ ਨੂੰ ਮਾਰਿਆ ਗਿਆ ਭਗਤ ਸਿੰਘ ਦੇ ਆਜ਼ਾਦੀ ਸੰਗਰਾਮ ਵਿੱਚ ਪਾਏ ਯੋਗਦਾਨ ਬਾਰੇ ਭਗਤ ਸਿੰਘ ਦੀ ਸੋਚ ਅਤੇ ਲਹਿਰਾਂ ਨੇ ਸਮਾਜਿਕ ਨਿਆਂ ਅਤੇ ਵਿਸ਼ਵਾਸਾਂ 'ਤੇ ਬਹੁਤ ਪ੍ਰਭਾਵ ਪਾਇਆ ਉਹ ਸਮਾਜਵਾਦੀ ਅਤੇ ਦਮਨਕਾਰੀ ਰਾਗ ਸਮਾਜਵਾਦੀ ਵਿਚਾਰਧਾਰਾ ਦੇ ਸਮਰਥਕ ਰਹੇ ਜਿਸ ਨੇ ਉਹਨਾਂ ਨੂੰ ਧੰਨਦਾਰਾਂ ਅਤੇ ਦਮਨਕਾਰੀ ਰਾਜ ਦੇ ਖਿਲਾਫ ਲੜ ਲੜਾਈ ਕਰਨ ਲਈ ਪ੍ਰੇਰਿਤ ਕੀਤਾ ਉਹ ਇਹ ਮੰਨਦੇ ਸਨ ਕਿ ਆਜ਼ਾਦੀ ਲੜਾਈ ਵਿੱਚ ਸਿਰਫ ਬ੍ਰਿਸ਼ਟ ਸਰਕਾਰ ਦੇ ਖਿਲਾਫ ਹੀ ਨਹੀਂ ਸਗੋਂ ਸਮਾਜਿਕ ਅਸਮਾਨਤਾ ਦੇ ਖਿਲਾਫ ਵੀ ਲੜਾਈ ਜ਼ਰੂਰੀ ਹੈ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਉੱਨੀ ਸੌ ਵੀਹ ਉਨੱਤੀ ਵਿੱਚ ਜੇਲ ਭੇਜਿਆ ਗਿਆ ਜੇਲ ਵਿੱਚ ਉਹਨਾਂ ਨੇ ਦੰਗਾ ਸ਼ੁਰੂ ਕੀਤਾ ਅਤੇ ਭੋਜਨ ਕਰਕੇ ਆਪਣੇ ਹੱਕਾਂ ਦੀ ਮੰਗ ਕੀਤੀ ਇਸ ਦੌਰਾਨ ਉਹਨਾਂ ਨੇ ਜੇਲ ਵਿੱਚ ਹੋ ਰਹੀ ਬਦਹਾਲੀ ਅਤੇ ਕੈਦੀਆਂ ਦੇ ਹੱਕਾਂ ਲਈ ਆਵਾਜ਼ ਉਠਾਈ ਭਗਤ ਸਿੰਘ ਦੀ ਲਿਖਾਈ ਦੇ ਵੀ ਬਹੁਤ ਪ੍ਰਭਾਵ ਪਾਇਆ ਉਹਨਾਂ ਦੇ ਲੇਖਾਂ ਵਿੱਚ ਅੱਜ ਵੀ ਉਹਨਾਂ ਦੇ ਅਤੇ ਲਿਖ ਲਿਖਤ 'ਤੇ ਲੋਕ ਚੱਲਣ ਦੀ ਕੋਸ਼ਿਸ਼ ਕਰਦੇ ਹਨ ਉਹ ਲੋ ਉਹ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਉੱਨੀ ਸੌ ਅਠਾਈ ਵਿੱਚ ਸਿਟੀ ਪੁਲਿਸ ਦੇ ਅਧਿਕਾਰੀ ਦੇ ਵਿਰੁੱਧ ਹਮਲਾ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਯੋਜਨਾ ਬਣਾਈ